ਮੇਰੇ ਕੋਲ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਜਦੋਂ ਮੈਂ ਛੋਟੀ ਹੁੰਦੀ ਸੀ ਮੇਰੇ ਮਾਤਾ ਪਿਤਾ ਨਾਲ ਬਹੁਤ ਸਾਰੀਆਂ ਤਸਵੀਰਾਂ ਹਨ ਉਹ ਤਸਵੀਰਾਂ ਮੈਨੂੰ ਬਹੁਤ ਜ਼ਿਆਦਾ ਪੁਰਾਣੇ ਸਮੇਂ ਦੀਆਂ ਯਾਦਾਂ ਦਿਲਾਉਂਦੀਆਂ ਹਨ ਪੁਰਾਣੇ ਸਮੇਂ ਵਿੱਚ ਅਸੀਂ ਹਰ ਫੋਟੋ ਬਾਹਰ ਸਟੂਡੀਓ ਵਿੱਚ ਜਾ ਕੇ ਕਰਵਾਉਂਦੇ ਸੀ ਪਰ ਅੱਜ ਦੇ ਸਮੇਂ ਵਿੱਚ ਫੋਟੋਆਂ ਫੋਨ ਤੋਂ ਹੀ ਲਈਆਂ ਜਾਂਦੀਆਂ ਹਨ ਅੱਜ ਕੱਲ੍ਹ ਫੋਟੋ ਬਹੁਤ ਜ਼ਿਆਦਾ ਨ ਕੋਮਨ ਚੀਜ਼ ਹੋ ਗਈ ਹੈ ਪਹਿਲਾਂ ਦੇ ਸਮੇਂ ਵਿੱਚ ਫੋਟੋਆਂ ਸਿਰਫ਼ ਜਦੋਂ ਕੋਈ ਵੀ ਯਾਦਗਰ ਰੱਖਣੀ ਹੁੰਦੀ ਸੀ ਉਦੋਂ ਹੀ ਲਈਆਂ ਜਾਂਦੀਆਂ ਸਨ ਪਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਜਗ੍ਹਾ ਦੀ ਫੋਟੋ ਪਾ ਦਿੱਤੀ ਜਾਂਦੀ ਹੈ ਸੋਸ਼ਲ ਮੀਡੀਆ ਉੱਪਰ ਪਰ ਪਹਿਲਾਂ ਦੇ ਸਮੇਂ ਵਿੱਚ ਬਹੁਤ ਥੋੜ੍ਹੀਆਂ ਫੋਟੋਆਂ ਹੁੰਦੀਆਂ ਸਨ ਹੁਣ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਪਾਈਆਂ ਜਾਂਦੀਆਂ ਹਨ ਪਹਿਲਾਂ ਦੇ ਸਮੇਂ ਵਿੱਚ ਫੋਟੋਆਂ ਦੀ ਐਲਬਮ ਬਣਾਈ ਜਾਂਦੀ ਸੀ ਪਰ ਅੱਜ ਕੱਲ੍ਹ ਸਿਰਫ਼ ਫੋਨਾਂ ਦੇ ਵਿੱਚ ਹੀ ਫੋਟੋ ਫੋਟੋ ਸੇਵ ਕਰਕੇ ਰੱਖੀ ਜਾਂਦੀ ਹੈ ਇਸ ਕਰਕੇ ਪੁਰਾਣਾ ਸਮਾਂ ਜ਼ਿਆਦਾ ਵਧੀਆ ਹੁੰਦਾ ਸੀ